ਵੇਖੋ ਜੀ ਨਿਊਜ਼ ਪੇਪਰ ਇੱਕ ਬਹੁਤ ਵਧੀਆ ਚੀਜ਼ ਹੈ ਜੀ ਹਰ ਘਰ ਵਿੱਚ ਇਹ ਨਿਊਜ਼ ਪੇਪਰ ਆਉਣਾ ਵੀ ਚਾਹੀਦਾ ਔਰ ਇਹਦੇ ਨਾਲ ਸਾਨੂੰ ਬਹੁਤ ਹੀ ਚੰਗੀਆਂ ਚੀਜ਼ਾਂ ਔਰ ਮਾੜੀਆਂ ਚੀਜ਼ਾਂ ਦਾ ਪਤਾ ਲੱਗਦਾ ਹੈ ਕਿੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਪ੍ਰਧਾਨ ਮੰਤਰੀ ਜੀ ਕੀ ਕਹਿ ਰਹੇ ਨੇ ਬਾਕੀ ਸਾਡੇ ਐਮ ਸੀ ਸਾਹਿਬ ਜਾਂ ਦੂਜੇ ਤੀਜੇ ਲਾਗੇ ਦੇ ਜਿੰਨੇ ਵੀ ਸਾਡੇ ਇੱਧਰ ਦੇ ਬਛਿੰਦੇ ਨੇ ਪਤਾ ਲੱਗਦਾ ਹੈ ਜੀ ਆਪਣੇ ਇਲਾਕੇ 'ਚ ਕੀ ਹੋ ਰਿਹਾ ਦੁਨੀਆ 'ਚ ਕੀ ਹੋ ਰਿਹਾ ਅਖ਼ਬਾਰ ਹਰ ਕਿਸੇ ਨੂੰ ਪੜ੍ਹਨੀ ਚਾਹੀਦੀ ਹੈ ਅਤੇ ਬਹੁਤ ਚਚ ਵਧੀਆ ਚੀਜ਼ਾਂ ਸਾਨੂੰ ਦੇਖਣ ਨੂੰ ਔਰ ਸੁਣਨ ਨੂੰ ਮਿਲਦੀਆਂ ਜਿਹੜੀ ਸਾਨੂੰ ਨਹੀਂ ਪਤਾ ਲੱਗਦਾ ਉਸ ਲਈ ਹਰ ਕਿਸੇ ਨੂੰ ਅਖ਼ਬਾਰ ਜ਼ਰੂਰ ਪੜ੍ਹਨੀ ਚਾਹੀਦੀ ਹੈ ਅਖ਼ਬਾਰ ਪ ਬੱਚਿਆਂ ਨੂੰ ਵੀ ਪੜ੍ਹਨੀ ਚਾਹੀਦੀ ਹੈ ਅਤੇ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ